ਮੇਰੇ ਕੋਲ ਮਨਪਸੰਦ ਪੰਜਾਬੀ ਕਹਾਵਤਾਂ ਅਤੇ ਮੁਹਾਵਰੇ ਇਸ ਤਰ੍ਹਾਂ ਹਨ ਪੱਲੇ ਨਹੀਂ ਧੇਲਾ ਕਰਦੀ ਮੇਲਾ ਮੇਲਾ ਤੂੰ ਚੱਲ ਮੈਂ ਆਇਆ ਨੌ ਦੋ ਗਿਆਰਾਂ ਹੋਣਾ ਘੜੇ ਨੂੰ ਹੱਥ ਲਾਇਆ ਤੇ ਸਾਰਾ ਟੱਬਰ ਤਿਹਾਇਆ ਔਲੇ ਦਾ ਖਾਧਾ ਅਤੇ ਸਿਆਣੇ ਦਾ ਬੋਲਿਆ ਬਾਅਦ 'ਚ ਪਤਾ ਲੱਗਦਾ